ਸਵੱਛ ਭਾਰਤ ਅਭਿਆਨ ਦਾ ਸਾਡੇ ਅਤੇ ਸਾਡੇ ਨੇੜੇ ਤੇੜੇ ਦੇ ਆਮ ਪਬਲਿਕ 'ਤੇ ਬਹੁਤ ਚੰਗਾ ਅਸਰ ਪਿਆ ਹੈ ਇਸ ਦੇ ਨਾਲ ਇੱਕ ਤਾਂ ਸਫਾਈ ਹੈ ਜੋ ਸਫਾਈ ਹਰੇਕ ਵਾਰ ਹਰੇਕ ਆਪਣੇ ਘਰਾਂ ਕੇ ਸਫਾਈ ਕਰ ਰਿਹਾ ਅਤੇ ਜੇ ਨ ਸਫਾਈ ਕਰਨ ਨਾਲ ਮੱਛਰ ਮਲੇਰੀਆ ਬਿਮਾਰੀਆਂ ਤੋਂ ਬਿਮਾਰੀਆਂ ਦਾ ਜੋ ਖਤਰਾ ਹੈ ਉਹ ਤੋਂ ਬਚਿਆ ਬਚਾਅ ਹੋਇਆ ਹੈ ਅਤੇ ਸਾਡੇ ਆਲੇ ਦੁਆਲੇ ਜਿਵੇਂ ਕਿ ਗੰਦਗੀ ਵਾਲਾ ਕੋਈ ਵੀ ਸਰਕਾਰੀ ਆਪਣਾ ਸ ਜ਼ਮੀਨ ਸੀ ਉੱਥੇ ਅਸੀਂ ਸਾਫ ਕਰਵਾ ਕੇ ਬੂਟੇ ਵਗੈਰਾ ਲਾ ਕੇ ਸਾਫ ਕੀਤਾ ਹੈ ਅਤੇ ਇਸਨੂੰ ਸੁਧਾਰ ਕਰਨ ਲਈ ਜ ਇਹ ਹੈ ਕਿ ਜਿਵੇਂ ਕੂਲਰਾਂ ਵਗੈਰਾ ਵਿੱਚ ਪਾਣੀ ਰੱਖ ਛੱਡਦੇ ਹਾਂ ਪਿੰਡਾਂ ਵਾਲੇ ਉਹਨਾਂ ਨੂੰ ਉਹਨਾਂ ਦੀ ਸਫਾਈ ਕਰਵਾਉਣੀ ਚਾਹੀਦੀ ਹੈ ਅਤੇ ਜਿਮ ਜਿੱਥੇ ਕਿਤੇ ਆਪਾਂ ਨੂੰ ਥੋੜ੍ਹਾ ਬਹੁਤਾ ਗੰਦਗੀ ਦਿਖਦੀ ਹੈ ਉੱਥੇ ਨੇੜੇ ਤੇੜੇ ਦੇ ਬੰਦਿਆਂ ਨੂੰ ਸਮਝਾ ਕੇ ਸਵੱਛ ਅਭਿਆਨ ਬਾਰੇ ਦੱਸ ਕੇ ਸਾਰੀ ਮੁਹਿੰਮ ਬਾਰੇ ਦੱਸ ਕੇ ਸਫਾਈ ਕਰਵਾਉਣੀ ਚਾਹੀਦੀ ਹੈ